ਸਤਾਰ੍ਹਾਂ ਦਸੰਬਰ ਉੱਨੀ ਸੌ ਉਣਾਸੀ ਅਠਾਰ੍ਹਾਂ ਅਪ੍ਰੈਲ ਉੱਨੀ ਸੌ ਅਠਾਰ੍ਹਾਂ ਵੀਹ ਦਸੰਬਰ ਪੰਦਰਾਂ ਸੌ ਪੈਂਹਠ ਬਾਈ ਅਕਤੂਬਰ ਬਾਰ੍ਹਾਂ ਸੌ ਛਪੰਜਾ ਅਠਾਈ ਜਨਵਰੀ ਸਤਾਰ੍ਹਾਂ ਸੌ ਪਚੱਤਰ